ਹੈਲੋ ਰਿਹਾ ਸੀ ਸਰ ਆਪਣੀ ਕਰਿਆਨੇ ਦੀ ਸ਼ੋਪ ਐ ਜੀ ਹਾਂਜੀ ਸਰ ਆਪਣੇ ਹਾਂਜੀ ਆਪਣੇ ਪੜੋਸੀਆਂ ਨੇ ਜਾਗਰਨ ਫੰਕਸ਼ਨ ਸੀਗੇ ਆਪਣੇ ਸਮਾਨ ਲੈ ਗਏ ਸੀ ਆਪਣੇ ਮੈਰਜ ਹੈਗੀ ਉਹਦੇ ਵਾਸਤੇ ਸਮਾਨ ਲੈਣ ਆਉਣਾ ਸੀਗਾ ਜੀ ਠੀਕ ਹੈ ਠੀਕ ਹੈ ਜੀ ਜਿਵੇਂ ਕਿ ਆਪਣੇ ਕੋਲ ਕੋਈ ਹਲਵਾਈ ਦੇ ਸਮਾਨ ਤੋਂ ਹੋਏਗਾ ਚੀਨੀ ਵਗੈਰਾ ਹੋ ਗਈ ਹਾਂਜੀ ਚਲੋ ਜੀ ਚਾਵ ਚਾਵਲ ਨੇਗੇ ਇੱਕ ਤਾਂ ਆਪਾਂ ਬਾਸਮਤੀ ਹੁੰਦੀ ਨੇ ਵਧੀਆ ਚ ਜੀ ਆਪਣੇ ਕੋਲੇ ਸਭ ਤੋਂ ਟੋਪ ਚ ਕਿਹੜੇ ਮਿਲਣਗੇ ਉਸ ਤੋਂ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਾਵਲ ਲੱਗ ਜਾਣਗੇ ਪੰਜਾਹ ਤੋਂ ਪਚਵੰਜਾ ਦੇ ਵਿਚ ਜੀ ਹਾਂਜੀ ਠੀਕ ਹੈ ਜੀ ਆਪਣੇ ਦੋ ਫੰਕਸ਼ਨ ਹੈ ਜੀ ਇੱਕ ਦਾ ਘਰ ਪਰ ਰੱਖਣਾ ਇੱਕ ਪੈਲਿ ਦਾ ਹੈਗਾ ਪੰਜਾਹ ਤੋਂ ਪਚਵੰਜਾ ਕਿਲੋ ਆਉਗਾ ਇਕ ਜਿਹੜੀ ਮਸਾਲੇ ਹੋਣਗੇ ਕਿਸੇ ਵਧੀਆ ਕੰਪਨੀ ਲਈ ਲੈਣੇ ਜਿਵੇਂ ਕਿ ਇਮਲੀ ਅੱਛੀ ਹੋਏ ਠੀਕ ਹੈ ਜੀ ਡਿਸਪੋਜਲ ਵਗੈਰਾ ਜਾਂ ਕੋਲਡ ਡਰਿੰਕ ਠੀਕ ਹੈ ਜੀ ਇਕ ਇੱਕ ਸਰ ਚਾਵਲ ਆਪਾਂ ਨੂੰ ਸਿੰਪਲ 'ਚ ਵੀ ਚਾਹੀਦੇ ਨੇ ਆ ਆਪਾਂ ਖੀਰ ਲਗੈਰਾ ਖੀਰ ਵਾਲੇ ਹੁੰਦੇ ਜਿਹੜੇ ਆਪਣੇ ਪਹਿਲਾਂ ਗੱਲ ਹੋਈ ਹ ਹਾਂਜੀ ਉਹ ਤਾਂ ਆਪਣੀ ਨਮਕੀਨ ਬਣਨ ਵਾਸਤੇ ਆ ਗਏ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਠੀਕ ਐ ਸਰ ਚਲੋ ਸਰ ਠੀਕ ਹੈ ਮੇਰੇ ਕੋਲ ਲਿਸਟ ਆਈ ਹੋਈ ਮੈਂ ਤੁਹਾਨੂੰ ਕੱਲ ਆ ਕੇ ਮਿਲਦਾ ਜੀ ਓਕ ਓਕੇ ਠੀਕ ਹੈ ਜੀ ਜੀ ਜੀ ਠੀਕ ਹੈ ਸਰ ਓਕੇ ਜੀ ਥੈਂਕਯੂ